ਕਪੂਰਥਲਾ ਜ਼ਿਲ੍ਹਾ ਜਲੰਧਰ ਜ਼ਿਲ੍ਹੇ ਦੇ ਨਾਲ ਲੱਗਦਾ ਹੈ ਇੱਥੇ ਦਾ ਤਾਪਮਾਨ ਪੰਜਾਬ ਦੇ ਤਾਪਮਾਨ ਵਰਗਾ ਹੀ ਹੈ ਇੱਥੇ ਬਹੁਤ ਜ਼ਿਆਦਾ ਗਰਮੀਆਂ ਵਿੱਚ ਬਹੁਤ ਗਰਮੀ ਅਤੇ ਬਹੁਤ ਸਰਦੀਆਂ ਵਿੱਚ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ ਕਿਉਂਕਿ ਇੱਥੇ ਵਿਸ਼ਵ ਕਿਸਮ ਦਾ ਤਾਪਮਾਨ ਪਾਇਆ ਜਾਂਦਾ ਹੈ ਗਰਮੀਆਂ ਵਿੱਚ ਬਹੁਤ ਹੀ ਜ਼ਿਆਦਾ ਗਰਮੀਆਂ ਹੁੰਦੀਆਂ ਹਨ ਹੜ੍ਹਾਂ ਦੇ ਮੌਕੇ ਸਰਦੀਆਂ ਸਾਡੇ ਇੱਥੇ ਹੜ੍ਹਾਂ ਹੜ੍ਹ ਵੀ ਆ ਜਾਂਦੇ ਹਨ ਕਿਉਂਕਿ ਇੱਥੇ ਸਤਲੁਜ ਦਰਿਆ ਲਾਗੇ ਪੈਂਦਾ ਹੈ ਅਤੇ ਇਸ ਕਾਰਨ ਇੱਥੇ ਕਈ ਵਾਰ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਥੇ ਜਦੋਂ ਸਰਦੀਆਂ ਹੁੰਦੀਆਂ ਹਨ ਬਹੁਤ ਹੀ ਜ਼ਿਆਦਾ ਧੁੰਦ ਹੁੰਦੀ ਹੈ ਜਿਸ ਕਾਰਨ ਆਵਾਜਾਈ ਦੇ ਸਾਧਨਾਂ ਵਿੱਚ ਬਹੁਤ ਦਿੱਕਤ ਆਉਂਦੀ ਹੈ ਨਜ਼ਰ ਬਹੁਤ ਹੀ ਘੱਟ ਜਾਂਦੀ ਹੈ ਇਸ ਕਾਰਨ ਸਾਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਕਿਨ ਗਰਮੀਆਂ ਦਾ ਮੌਸਮ ਇੱਥੇ ਬਹੁਤ ਵਧੀਆ ਹੁੰਦਾ ਹੈ ਇੱਥੇ ਹਵਾਵਾਂ ਚਲਦੀਆਂ ਹਨ ਅਤੇ ਬਹੁਤ ਹੀ ਵਧੀਆ ਕਿਸਮ ਦੀ ਕਿਸਮ ਦਾ ਮੌਸਮ ਅਨੁਭਵ ਹੁੰਦਾ ਹੈ ਗਰਮੀਆਂ ਤੋਂ ਬਾਅਦ ਇੱਥੇ ਜਦੋਂ ਮਾਨਸੂਨ ਆਉਂਦਾ ਹੈ ਤਾਂ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੋ ਜਾਂਦੀ ਹੈ ਅਤੇ ਅਸੀਂ ਬਹੁਤ ਹੀ ਆਨੰਦ ਮਾਣਦੇ ਹਾਂ ਮਾਨਸੂਨ ਦੀਆਂ ਬਾਰਸ਼ਾਂ ਬਹੁਤ ਹੀ ਵਧੀਆ ਲੱਗਦੀਆਂ ਹਨ ਅਤੇ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਵੀ ਬਹੁਤ ਹੀ ਵਧੀਆ ਹੋ ਜਾਂਦਾ ਹੈ ਅਸੀਂ ਆਪਣੇ ਇਸ ਮੌਸਮ ਨੂੰ ਬਹੁਤ ਧੰਨਵਾਦ